ਪੱਚੀ ਸਤੰਬਰ ਉੱਨੀ ਸੌ ਨੜਿੱਨਵੇਂ ਚਾਰ ਜੁਲਾਈ ਦੋ ਹਜ਼ਾਰ ਤਿੰਨ ਛੱਬੀ ਜੁਲਾਈ ਦੋ ਹਜ਼ਾਰ ਅੱਠ ਸੱਤ ਮਾਰਚ ਉੱਨੀ ਸੌ ਸਤੱਤਰ ਇੱਕ ਦਸੰਬਰ ਉੱਨੀ ਸੌ ਸਤੱਤਰ